ਅਗਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਕਿਸੇ ਮ੍ਰਿਤਕ ਰਿਸ਼ਤੇਦਾਰ ਦੀ ਮੌਤ ਸਹੀ ਢੰਗ ਨਾਲ ਦਰਜ ਨਹੀਂ ਕੀਤੀ ਗਈ ਤਾਂ ਸੰਬੰਧਿਤ ਹਸਪਤਾਲ ਵਿੱਚ ਜਾ ਕੇ ਉਸਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਅਤੇ ਸੰਬੰਧਿਤ ਡਾਕਟਰ ਤੋਂ ਉਸ ਦਾ ਰਿਕੋਰਡ ਸਾਂਝਾ ਕਰਵਾਇਆ ਜਾ ਸਕਦਾ ਹੈ